ਹਾਂਜੀ ਭਾਰਤ ਵਿੱਚ ਪ੍ਰਾਚੀਨ ਅਤੇ ਮੱਧਕਾਲੀ ਦੌਰ ਵਿੱਚ ਸਾਡੇ ਕੁਝ ਮਸ਼ਹੂਰ ਰਾਜੇ ਰਹੇ ਹਨ ਜਿਵੇਂ ਛਤਰਪਤੀ ਸ਼ਿਵਾਜੀ ਪ੍ਰਿਥਵੀ ਰਾਜ ਚੌਹਾਨ ਮਹਾਰਾਜਾ ਰਣਜੀਤ ਸਿੰਘ ਮਹਾਰਾਣਾ ਪ੍ਰਤਾਪ ਸਿੰਘ ਵੀ ਰਹੇ ਹਨ ਅਤੇ ਇਹਨਾਂ ਨੇ ਬਹੁਤ ਵਧੀਆ ਕੰਮ ਵੀ ਕੀਤੇ ਹਨ ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾ ਨਾਂ ਬੁੱਧ ਸਿੰਘ ਵੀ ਸੀ ਅਤੇ ਇਹ ਗੁੱਜਰਾਂ ਵਾਲੇ ਪਿੰਡ ਪਾਕਿਸਤਾਨ ਵਿਖੇ ਹੋਏ ਇਹ ਮਹਾਂ ਸਿੰਘ ਜੀ ਦੇ ਘਰ ਹੋਏ ਮਹਾਂ ਸਿੰਘ ਅਤੇ ਸਰਦਾਰਨੀ ਰਾਜ ਕੌਰ ਜੀ ਦੇ ਘਰ 'ਤੇ ਤੇਰਾਂ ਨਵੰਬਰ ਸਤਾਰਾਂ ਸੌ ਈਸਵੀ ਵਿੱਚ ਹੋਏ ਸਨ ਅਤੇ ਇਹਨਾਂ ਨੇ ਸਿੱਖ ਰਾਜ ਨੂੰ ਚਾਲੀ ਸਾਲ ਵਿੱਚ ਸਥਾਪਿਤ ਕੀਤਾ ਇਹਨਾਂ ਨੇ ਕੋਈ ਵੀ ਮਾੜਾ ਕੰਮ ਨਹੀਂ ਕੀਤਾ ਅਤੇ ਹਮੇਸ਼ਾ ਇਸ ਸ਼ਾਂਤਮਈ ਢੰਗ ਨਾਲ ਹੀ ਸਾਰੇ ਕੰਮ ਕੀਤੇ ਹਨ ਇਹ ਧਰਮ ਵਿੱਚ ਇਹ ਧਰਮ ਵਿੱਚ ਕੋਈ ਵਿਤਕਰਾ ਨਹੀਂ ਕਰਦੇ ਸਨ ਅਤੇ ਇਹਨਾਂ ਨੇ ਸਰਕਾਰ ਏ ਖਾਲਸਾ ਵੀ ਚਲਾਇਆ ਇਨ੍ਹਾਂ ਨੇ ਹਰਿਮੰਦਰ ਸਾਹਿਬ ਗੋਲਡਨ ਟੈਂਪਲ ਸੋਨੇ ਦਾ ਬਣਵਾਇਆ ਸੀ ਬਾਰਾਂ ਅਪ੍ਰੈਲ ਅਠਾਰਾਂ ਸੌ ਇੱਕ ਸਦੀ ਵਿੱਚ ਇਹਨਾਂ ਨੂੰ ਗੁਰਗੱਦੀ ਵੀ ਮਿਲੀ ਹੈ ਅਤੇ ਇਨ੍ਹਾਂ ਇਹ ਇਹਨਾਂ ਨੇ ਲਾਹੌਰ ਨੂੰ ਆਪਣੀ ਰਾਜਧਾਨੀ ਬਣਵਾਇਆ ਬਣਾਇਆ ਸੀ ਉਸ ਸਮੇਂ ਅਫਗਾਨ ਆਤੰਕ ਮਚਾ ਰਹੇ ਸਨ ਅਤੇ ਕੁੱਟਮਾਰ ਕੁੱਟਮਾਰ ਵੀ ਕਰ ਰਹੇ ਸਨ ਉਨ੍ਹਾਂ ਇਹਨਾਂ ਨੇ ਅਫਗਾਨ ਦੇ ਵਿਰੁੱਧ ਕਈ ਲੜਾਈਆਂ ਵੀ ਲੜੀਆਂ ਹਨ ਜਿਸ ਜਿਸ ਕਰਕੇ ਅਫਗਾਨ ਪੱਛਮੀ ਪੰਜਾਬ ਵੱਜ ਵੱਲ ਦੌੜ ਗਏ ਅਤੇ ਇਹ ਇਹਨਾਂ ਨੇ ਪਿਸ਼ਾਵਰ 'ਤੇ ਪਸ਼ਤੂਨੀ 'ਤੇ ਕਬਜ਼ਾ ਵੀ ਕੀਤਾ ਹੈ ਜਿੱਥੇ ਇਸ ਤੋਂ ਪਹਿਲਾਂ ਗੈਰ ਮੁਸਲਿਮ ਨੇ ਰਾਜ ਨਹੀਂ ਕੀਤਾ ਸੀ ਅਨੰਦਪੁਰ ਸਾਹਿਬ ਤੱਕ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੋਈ ਹੈ ਵਿਸ਼ਾਲ ਸੈਨਾ ਬਣਾਈ ਜਿਸ ਨੂੰ ਸਿੱਖ ਰਾਜ ਦਾ ਨਾਂ ਦਿੱਤਾ ਗਿਆ ਸੀ